ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਵੀਰ ਜੀ ਮੈਂ ਨਾ ਵੀ ਦੋ ਦਿਨ ਪਹਿਲਾਂ ਔਨਲਾਈਨ ਔਨਲਾਈਨ ਜੁੱਤੀ ਮੰਗਵਾਈ ਸੀ ਜੀ ਮੈਨੂੰ ਉਹਨਾ ਦਾ ਨਾ ਵੀ ਸਾਈਜ਼ ਛੋਟਾ ਆਇਆ ਹੈ ਹਾਂਜੀ ਅਤੇ ਵੀਰ ਜੀ ਮੈਂ ਨਾ ਵੱਡਾ ਸਾਈਜ ਮੰਗਵਾਉਣਾ ਹੈ ਹਾਂਜੀ ਜੀ ਠੀਕ ਵੱਡਾ ਸਾਇਜ ਮੰਗਵਾਉਣਾ ਹੈ ਅਤੇ ਇੱਕ ਰਿਕੁਐਸਟ ਹੈ ਵੀ ਤੁਸੀਂ ਮੈਨੂੰ ਉਹਦਾ ਵੱਡਾ ਸਾਈਜ਼ ਵੀ ਔਡਰ ਕਰ ਸਕਦੇ ਹੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਜੇ ਤੁਸੀਂ ਵੀ ਮੈਨੂੰ ਵੱਡਾ ਸਇਜ ਇੱਕ ਨੰਬਰ ਵੱਡਾ ਦੇ ਦਿਓ ਹਾਂਜੀ ਕਿਉਂਕਿ ਵੀਰ ਜੀ ਜੇ ਮੈਂ ਰੱਖਾਂ ਤਾਂ ਮੇਰਾ ਵੀ ਇਹ ਸਾਈਜ਼ ਬੇਕਾਰ ਜਾਣਾ ਜੋੜਾ ਬੇਕਾਰ ਜਾਣਾ ਹੈ ਹਾਂ ਜੀ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਜੇ ਤੁਸੀਂ ਮੈਨੂੰ ਇੱਕ ਨੰਬਰ ਵੱਡਾ ਕਰ ਦਿਓ ਹਾਂਜੀ ਮੈਂ ਆਨਲਾਈਨ ਆਰਡਰ ਕੀਤੀ ਸੀ ਹਾਂਜੀ ਹਾਂਜੀ ਦੋ ਦਿਨ ਪਹਿਲਾਂ ਹੀ ਕੀਤੀ ਸੀ ਜੀ ਇਹ ਆਪਣੇ ਕੋਲ ਕਿੰਨੇ ਦਿਨ ਦੀ ਮੋਹਲਤ ਹੁੰਦੀ ਹੈ ਵੀਰ ਜੀ ਠੀਕ ਠੀਕ ਹੈ ਵੀਰ ਜੀ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੀ ਜੀ ਜੇ ਤੁਸੀਂ ਮੈਨੂੰ ਇੱਕ ਨੰਬਰ ਵੱਡਾ ਹਾਂਜੀ ਹਾਂਜੀ ਹਾਂਜੀ ਕ ਕੱਲ੍ਹ ਨੂੰ ਵੀਰੇ ਲੈ ਜਾਓਗੇ ਵਾਪਸ ਵੱਡਾ ਨਮਬ ਹਾਂਜੀ ਹਾਂਜੀ ਇੱਕ ਨੰਬਰ ਵੱਡਾ ਮਿਲ ਜਾਏ ਹਾਂਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਹੈ ਹਾਂਜੀ ਹਾਂਜੀ ਇਸ ਹੀ ਪ ਹਾਂਜੀ ਇਸ ਹੀ ਪਤੇ 'ਤੇ ਅ ਹਾਂਜੀ ਹਾਂ ਹਾਂਜੀ ਹਾਂਜੀ ਠੀ ਠੀਕ ਹੈ ਵੀਰ ਠੀਕ ਹੈ ਥੈਂਕ ਯੂ ਵੀਰ ਜੀ ਥੈਂਕ ਯੂ